ਪੰਜਾਬ ਵਿੱਚ ਜਿਹੜਾ ਮਤਲਬ ਇੱਕ ਦੂਜੇ ਨਾਲ ਜੁੜਨ ਦਾ ਮਤਲਬ ਜਾਂ ਮਨੋਰੰਜਨ ਦਾ ਕਹਿ ਲਉ ਜਾਂ ਜੁੜਨ ਦਾ ਕਹਿ ਲਉ ਹੈ ਨਾ ਕਿ ਪੰਜਾਬ ਵਿੱਚ ਕਾਫੀ ਤਰ੍ਹਾਂ ਦੀਆਂ ਖੇਡਾਂ ਵਗੈਰਾ ਹੈਗੀਆਂ ਹੈ ਨਾ ਜਿਨ੍ਹਾਂ ਨਾਲ ਮਤਲਬ ਆਪਸੀ ਤਾਲਮੇਲ ਜਾਂ ਆਪਸੀ ਪਿਆਰ ਬਣਿਆ ਰਹਿੰਦਾ ਜਿੱਦਾਂ ਕਿ ਬੰਦਾ ਕਾਫੀ ਪਹਿਲਾਂ ਦੇ ਜ਼ਮਾਨੇ ਵਿੱਚ ਲੁਡੋ ਖੇਡ ਲੈਂਦੇ ਸੀ ਜਾਂ ਕੁਛ ਵੀ ਹੈ ਨਾ ਉਹਦੇ ਵਿੱਚ ਕੀ ਹੈ ਮਤਲਬ ਘਰਾਂ 'ਚ ਇੱਦਾਂ ਜਵਾਕ ਇਕੱਠੇ ਹੋ ਖੇਡ ਲੈਂਦੇ ਸੀ ਉਸ ਨਾਲ ਆਪਸੀ ਪਿਆਰ ਬਣਿਆ ਰਹਿੰਦਾ ਸੀਗਾ ਅਤੇ ਜਿੱਦਾਂ ਮਤਲਬ ਲੁਡੋ ਕਹਿ ਲਉ ਤੁਸੀਂ ਜਾਂ ਘਰਾਂ 'ਚ ਬੁੜੀਆਂ ਆਪਸ ਇਕੱਠੀਆਂ ਹੋ ਕੇ ਮਤਲਬ ਸ਼ਾਮ ਨੂੰ ਗਲੀ 'ਚ ਬਹਿ ਉਹਨਾਂ ਆਪਸ 'ਚ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਸੀ ਹੈ ਨਾ ਉਹਨਾਂ ਦੇ ਨਾਲ ਕੀ ਹੈ ਬੰਦੇ ਦਾ ਮਨੋਰੰਜਨ ਵੀ ਹੋ ਜਾਂਦਾ ਸੀ ਅਤੇ ਇੱਕ ਨਾਲ ਜੁੜੇ ਰਹਿੰਦੇ ਸੀ ਬੰਦਾ ਆਪਸ 'ਚ ਦੁੱਖ ਸੁੱਖ ਕਰਦਾ ਕਦੇ ਬੰਦਾ ਦੁੱਖ ਦੇ ਟਾਈਮ 'ਤੇ ਇੱਕ ਦੂਜੇ ਨਾਲ ਹੁੰਦਾ ਸੁੱਖ ਦੇ ਟਾਈਮ ਇੱਕ ਦੂਜੇ ਨਾਲ ਹੁੰਦਾ ਹੈ ਨਾ ਉਹਦੇ 'ਚ ਕੀ ਹੈ ਬੰਦੇ ਦਾ ਜਿਹੜਾ ਆਪਸੀ ਪਿਆਰ ਆ ਉਹ ਵੱਧਦਾ ਆ ਅਤੇ ਫੈਮਲੀਆਂ ਜਿਹੜੇ ਘਰ ਆ ਪਰਿਵਾਰ ਆ ਉਹ ਆਪਸ 'ਚ ਇੱਕ ਦੂਜੇ ਨਾਲ ਜੁੜੇ ਰਹਿੰਦੇ ਆ ਜੇ ਪਰਿਵਾਰ ਇੱਕ ਦੂਜੇ ਨਾਲ ਜੁੜਦੇ ਰਹਿੰਦੇ ਤਾਂ ਪਰਿਵਾਰ 'ਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਬੰਦੇ ਨੂੰ ਹੈ ਨਾ ਜਿਵੇਂ ਕਿ ਪਹਿਲਾਂ ਵਾਲੇ ਜ਼ਮਾਨੇ 'ਚ ਜਾਂ ਹੁਣ ਵਾਲੇ ਕਹਿ ਲਉ ਪੰਜਾਬ ਸਭ ਤੋਂ ਵੱਡਾ ਆਪਸੀ ਤਾਲਮੇਲ ਇੱਕ ਦੂਜੇ ਨਾਲ ਗੱਲ ਕਰਨ ਦੇ ਤਰੀਕੇ ਨੂੰ ਮਾਧਿਅਮ ਨੂੰ ਉਹ ਕਿਹਾ ਜਾਂਦਾ